ਭਾਰਤ ਦੇ ਵਿੱਚ ਐਵੇਂ ਦੇ ਬਹੁਤ ਸਾਰੇ ਕਲਾਕਾਰ ਆ ਜਿਨ੍ਹਾਂ ਨੂੰ ਜਾਂ ਮੌਕੇ ਮਿਲਦੇ ਨਹੀਂ ਆ ਜਾਂ ਫਿਰ ਮੌਕੇ ਦਿੱਤੇ ਨਹੀਂ ਜਾਂਦੇ ਇਹਨਾਂ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਕਈ ਲੋਕਾਂ ਨੂੰ ਉਹਨਾਂ ਦੀ ਕਲਾ ਬਾਰੇ ਜਾਣਕਾਰੀ ਨਹੀਂ ਹੁੰਦੀ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਅੰਦਰ ਇਹ ਕਲਾ ਹੈ ਉਹ ਆਪਣੇ ਉਸ ਕਲਾ ਨੂੰ ਲੱਭ ਨਹੀਂ ਪਾਉਂਦਾ ਕਈ ਵਾਰ ਫੈਮਲੀ ਪ੍ਰੋਬਲਮ ਆ ਜਾਂਦੀ ਆ ਕਈ ਕਲਾਕਾਰਾਂ ਨੂੰ ਉਹਨਾਂ ਦੀ ਫੈਮਲੀ ਸਪੋਰਟ ਨਹੀਂ ਕਰਦੀ ਉਹਨਾਂ ਦੀ ਕਲਾ ਦੇ ਵਿੱਚ ਜਿਵੇਂ ਕਈਆਂ ਨੂੰ ਗਾਉਣਾ ਪਸੰਦ ਹੁੰਦਾ ਹੈ ਬਟ ਉਹਨਾਂ ਦੀ ਫੈਮਿਲੀ ਸਪੋਰਟ ਨਹੀਂ ਕਰਦੀ ਕਿ ਸਾਡਾ ਬੱਚਾ ਜਾਂ ਫਿਰ ਸਾਡਾ ਭਰਾ ਜਾਂ ਭੈਣ ਗਾਵੇ ਜਾਂ ਸਿੰਗਰ ਬਣੇ ਕਈ ਕਲਾਕਾਰ ਕਈਆਂ ਨੂੰ ਡਾਂਸ ਕਈਆਂ ਦੇ ਵਿੱਚ ਕਲਾ ਹੁੰਦੀਆਂ ਹੈ ਕਿ ਉਹ ਬਹੁਤ ਵਧੀਆ ਡਾਂਸ ਕਰ ਲੈਂਦੇ ਆ ਬਟ ਉਹਨਾਂ ਨੂੰ ਸ ਫੈਮਲੀ ਸਪੋਰਟ ਨਹੀਂ ਕਰਦੀ ਕਿ ਸਾਡਾ ਬੱਚਾ ਇੱਕ ਇਸ ਲਾਈਨ ਦੇ ਵਿੱਚ ਆਪਣਾ ਪ੍ਰੋਫੈਸ਼ਨ ਚੁਣੇ ਜਾਂ ਫਿਰ ਇਹਨੂੰ ਅੱਗੇ ਲੈ ਕੇ ਜਾਵੇ ਕਈਆਂ ਨੂੰ ਫੈਮਲੀ ਦੇ ਨਾਲ ਨਾਲ ਪੈਸੇ ਦੀ ਵੀ ਪ੍ਰੋਬਲਮ ਆ ਜਾਂਦੀ ਆ ਫਾਈਨੈਸ਼ੀਅਲ ਸਪੋਰਟ ਨਹੀਂ ਮਿਲਦੀ ਕਿਉਂਕਿ ਆਪਣੀ ਕਲਾ ਨੂੰ ਨਿਖਾਰਨ ਦੇ ਲਈ ਆਪਾਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਆ ਉਸ ਕਲਾ ਦੇ ਵਿੱਚ ਆਪਾਂ ਨੂੰ ਰੁਚੀ ਹੁੰਦੀ ਆ ਬਟ ਕਿਤੇ ਨਾ ਕਿਤੇ ਪੈਸੇ ਦੀ ਜ਼ਰੂਰਤ ਪੈਂਦੀ ਆ ਕਈ ਵਾਰ ਆਪਣੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਸ ਕਲਾ ਨੂੰ ਆਪਾਂ ਨਿਖਾਰ ਪਾਈਏ ਇਸ ਲਈ ਇੱਕ ਪੈਸਾ ਵੀ ਇੱਕ ਕਾਰਨ ਬਣ ਜਾਂਦਾ ਆ ਜੋ ਕਿ ਆਪਾਂ ਆਪਾਂ ਨੂੰ ਆਪਣੀ ਜਿਹੜੀ ਕਿ ਮੌਕਾ ਨਹੀਂ ਦ ਮਿਲਦਾ ਜਾਂ ਫਿਰ ਕਹਿ ਲਓ ਮੌਕਾ ਦਿੱਤਾ ਨਹੀਂ ਜਾਂਦਾ ਕਈ ਵਾਰ ਆਪਾਂ ਨੂੰ ਇਹ ਜਗ੍ਹਾ ਇਹ ਤਰੀਕਾਂ ਨਹੀਂ ਪਤਾ ਹੁੰਦਾ ਕਿ ਆਪਾਂ ਆਪਣੀ ਕਲਾ ਨੂੰ ਕਿਵੇਂ ਨਿਖਾਰ ਨਿਖਾਰੀਏ